ਡੇਂਗੂ ਬੁਖਾਰ ਅਤੇ ਮਲੇਰੀਆ ਵਰਗੀਆਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਸਾਨੂੰ ਬਚਣ ਦੀ ਬਹੁਤ ਹੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਏਗਾ ਕਿ ਇਹ ਬਿਮਾਰੀਆਂ ਹੁੰਦੀਆਂ ਕਿਸ ਤਰ੍ਹਾਂ ਹਨ ਤੁਹਾਨੂੰ ਦੱਸ ਦੇਈਏ ਕਿ ਜਦੋਂ ਅਸੀਂ ਪਾਣੀ ਇਕੱਠਾ ਕਰਕੇ ਰੱਖ ਲੈਂਦੇ ਹਾਂ ਜਿਵੇਂ ਕਿ ਘਰਾਂ ਦੀਆਂ ਛੱਤਾਂ 'ਤੇ ਟਾਇਰਾਂ ਦੇ ਵਿੱਚ ਕੂਲਰਾਂ ਦੇ ਵਿੱਚ ਗਲੀਆਂ ਦੇ ਸੀਵਰੇਜ ਭਰੇ ਰਹਿੰਦੇ ਹਨ ਬਾਹਰ ਟੋਇਆਂ ਦੇ ਵਿੱਚ ਪਾਣੀ ਭਰਿਆ ਰਹਿੰਦਾ ਹੈ ਤਾਂ ਇਹ ਮੱਛਰ ਉੱਥੇ ਪਣਪਦਾ ਹੈ ਅਤੇ ਜਦੋਂ ਇਹ ਮੱਛਰ ਪਣਪਦਾ ਹੈ ਤਾਂ ਫਿਰ ਇਹ ਸਾਡੇ ਲਈ ਘਾਤਕ ਬਣ ਜਾਂਦਾ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰਾਂ ਦੀਆਂ ਛੱਤਾਂ ਵਗੈਰਾ ਨੂੰ ਸਾਫ਼ ਰੱਖੀਏ ਇਹਨਾਂ ਟਾਇਰਾਂ ਦੇ ਵਿੱਚ ਪਾਣੀ ਨਾ ਇਕੱਠਾ ਹੋਣ ਦੇਈਏ ਬਲਕਿ ਗੰਦਗੀ ਨੂੰ ਘਰੋਂ ਬਾਹਰ ਕਰ ਦੇਦੀਏ ਕੂਲਰਾਂ ਦੇ ਵਿੱਚ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਏ ਵੈਸੇ ਤਾਂ ਐਮ ਸੀ ਡੀ ਵੀ ਟਾਈਮ ਟੂ ਟਾਈਮ ਦਵਾਈਆਂ ਦਾ ਛਿੜਕਾ ਕਰਦੀ ਹੈ ਅਤੇ ਸੀਵਰੇਜ ਸਾਫ਼ ਸਫ਼ਾਈ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ ਵੱਡੀ ਚੁਣੌਤੀ ਜਿਹੜੀ ਹੈ ਉਹ ਹਨ ਬਰਸਾਤਾਂ ਅਤੇ ਬਰਸਾਤਾਂ ਦੇ ਵਿੱਚ ਅਸੀਂ ਕਿਵੇਂ ਬਚੀਏ ਇਸ ਦੇ ਲਈ ਸਾਨੂੰ ਖਾਸ ਧਿਆਨ ਦੇਣਾ ਪਵੇਗਾ ਬਰਸਾਤਾਂ ਦੇ ਵਿੱਚ ਅਸੀਂ ਆਪਣੇ ਆਲੇ ਦੁਆਲੇ ਦੀ ਅਗਰ ਸਾਫ਼ ਸਫ਼ਾਈ ਰੱਖਾਂਗੇ ਤਾਂ ਮੱਛਰ ਨਹੀਂ ਪਣਪੇਗਾ ਦਵਾਈਆਂ ਦਾ ਛਿੜਕਾ ਕਰਾਂਗੇ ਤਾਂ ਅਸੀਂ ਇਹਨਾਂ ਬਿਮਾ ਹੋ ਇਹਨਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਸਰਕਾਰਾਂ ਧਿਆਨ ਦੇ ਰਹੀਆਂ ਹਨ ਸਰਕਾਰਾਂ ਨੂੰ ਧਿਆਨ ਦੇਣਾ ਵੀ ਚਾਹੀਦਾ ਹੈ ਧੰਨਵਾਦ